ਮੇਰਾ ਦਾਗਿਸਤਾਨ ਕਿਤਾਬ ਮੇਰੀ ਮਨਪਸੰਦ ਕਿਤਾਬ ਹੈ ਇਹ ਕਿਤਾਬ ਰਸੂਲ ਹਮਜਾ ਤੋਪ ਦੁਆਰਾ ਲਿਖੀ ਹੋਈ ਹੈ ਅਤੇ ਇਸ ਨੂੰ ਪੰਜਾਬੀ ਦੇ ਵਿੱਚ ਅਨੁਵਾਦ ਕੀਤਾ ਹੋਇਆ ਹੈ ਇਹ ਕਿਤਾਬ ਮੈਨੂੰ ਇਸ ਕਰਕੇ ਵਧੀਆ ਲੱਗਦੀ ਹੈ ਕਿਉਂਕਿ ਇਹਦੇ ਵਿੱਚ ਮਾਤ ਭਾਸ਼ਾ ਦੀ ਮਹੱਤਤਾ ਨੂੰ ਬਿਆਨ ਕੀਤਾ ਹੋਇਆ ਹੈਗਾ ਮਾਤ ਭਾਸ਼ਾ ਜਿਸ ਨਾਲ ਬੱਚਾ ਸ਼ੁਰੂ ਤੋਂ ਜੁੜਿਆ ਹੁੰਦਾ ਹੈਗਾ ਅਤੇ ਉਸ ਦੀ ਇੱਕ ਮਹਾਰਤ ਹੁੰਦੀ ਹੈ ਮਾਤ ਭਾਸ਼ਾ ਦੇ ਵਿੱਚ ਮਾਤ ਭਾਸ਼ਾ ਦੇ ਵਿੱਚ ਅਸੀਂ ਆਪਣੇ ਵਿਚਾਰਾਂ ਨੂੰ ਇੱਕ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਬਿਆਨ ਕਰ ਸਕਦੇ ਹਾਂ ਜਿਹੜੀ ਕਿਸੇ ਹੋਰ ਭਾਸ਼ਾ ਦੇ ਵਿੱਚ ਨਹੀਂ ਕਰ ਸਕਦੇ ਮਾਤ ਭਾਸ਼ਾ ਵਿਅਕਤੀ ਦੇ ਵਿਅਕਤਿਤਵ ਦਾ ਵਿਕਾਸ ਕਰਨ ਦੇ ਵਿੱਚ ਭੂਮਿਕਾ ਨਿਭਾਉਂਦੀ ਹੈ ਤਾਂ ਮਾਤ ਭਾਸ਼ਾ ਦਾ ਉਹ ਇੰਨੀ ਜ਼ਿਆਦਾ ਮਹੱਤਤਾ ਦਿੰਦੇ ਆ ਲੇਖਕ ਲਿਖਦੇ ਆ ਕਿਤਾਬ ਦੇ ਵਿੱਚ ਕਿ ਜੇਕਰ ਤੁਸੀਂ ਕਿਸੇ ਨੂੰ ਬਦਦੁਆ ਦੇਣੀ ਹੋਵੇ ਤਾਂ ਉਸ ਨੂੰ ਕਹੋ ਕਿ ਜਾਹ ਤੈਨੂੰ ਤੇਰੀ ਮਾਂ ਬੋਲੀ ਭੁੱਲ ਜਾਵੇ ਸੋ ਸ ਮਾਂ ਬੋਲੀ ਹੈ ਜਿਹੜੀ ਹੈ ਨਾ ਉਹ ਹਰੇਕ ਮਨੁੱਖ ਦੇ ਜੀਵਨ ਦੇ ਵਿੱਚ ਇੱਕ ਅਹਿਮ ਰੋਲ ਅਦਾ ਕਰਦੀ ਹੈ ਸਾਨੂੰ ਮਾਂ ਬੋਲੀ ਦੇ ਨਾਲ ਜੁੜ ਕੇ ਉਹਦੀ ਮਹਾਨਤਾ ਨੂੰ ਪਛਾਨਣਾ ਚਾਹੀਦਾ ਹੈਗਾ ਅਤੇ ਇਹ ਕਿਤਾਬ ਆ ਜਿਹੜੀ ਉਹ ਮੈਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਇੱਕ ਪੁਸਤਕ ਮੇਲਾ ਲੱਗਿਆ ਸੀ ਅਤੇ ਉਸ ਤੋਂ ਮੈਂ ਇਹ ਕਿਤਾਬ ਖਰੀਦੀ ਸੀ